ਜੀ ਹਾਂ ਮੇਰੇ ਕੋਲ ਲਿਖਣ ਦੀਆਂ ਆਦਤਾਂ ਅਤੇ ਰੂਟੀਨ ਹਨ ਮੇਰੀ ਲਿਖਣ ਦੀ ਆਦਤਾਂ ਅਤੇ ਅਨੁਸ਼ਾਸ਼ਨ ਬਣਾਈ ਰੱਖਣ ਦੇ ਇਹ ਤਰੀਕੇ ਹਨ ਕਿ ਮੈਂ ਲਿਖਣ ਨੂੰ ਇੱਕ ਰੋਜ਼ਾਨਾ ਦੀ ਆਦਤ ਬਣਾਉਣ ਲਈ ਕੁਝ ਖ਼ਾਸ ਰੁਟੀਨ ਅਤੇ ਤਰੀਕੇ ਦੀ ਪਾਲਣਾ ਕਰਦੀ ਹਾਂ ਇਹ ਮੈਨੂੰ ਲਿਖਣ ਦੀ ਲਗਨ ਪ੍ਰੇਰਨਾ ਅਤੇ ਲਗਾਤਾਰਤਾ ਜਿਵੇਂ ਕੰਸਿਸਟੈਂਸੀ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ ਮੈਂ ਲੋ ਰੋਜ਼ ਸਮੇਂ 'ਤੇ ਲਿਖਦੀ ਹਾਂ ਮਤਲਬ ਰੋਜ਼ ਸਮੇਂ 'ਤੇ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਚਾਹੇ ਮੇਰੇ ਕੋਲ ਘੱਟ ਮੈਂ ਘੱਟ ਲਿਖਾਂ ਜਾਂ ਵੱਧ ਪਰ ਲਿਖਣ ਦੀ ਲਗਾਤਾਰਤਾ ਜ਼ਰੂਰੀ ਹੈ ਸਭ ਤੋਂ ਉੱਚੀ ਉਤਸ਼ਾਹਨਾ ਵਾਲਾ ਸਮੇਂ ਖੋਜਣਾ ਜਿਵੇਂ ਕੁਝ ਲੋਕ ਸਵੇਰੇ ਚੰਗਾ ਲਿਖਦੇ ਹਨ ਕੁਝ ਰਾਤ ਨੂੰ ਮੈਂ ਆਪਣੀ ਉਤਸ਼ਾਹਨਾ ਨੂੰ ਸਮਝ ਕੇ ਉਸ ਮੁਤਾਬਿਕ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਲਿਖਣ ਤੋਂ ਪਹਿਲਾਂ ਤਿਆਰੀ ਕਰਦੀ ਹਾਂ ਜਿਵੇਂ ਜਿਵੇਂ ਆਈਡੀਆ ਜਿੱਦਾਂ ਨੋ ਨੋਟਸ ਲਿ ਅ ਰੱਖਣਾ ਆਪਣੇ ਆਈਡੀਆਜ਼ ਨਾਲ ਮੈਂ ਲਿਖਦੀ ਹਾਂ ਜਦੋਂ ਵੀ ਕੋਈ ਨਵੀਂ ਸੋਚ ਆਉਂਦੀ ਹੈ ਮੈਂ ਉਸ ਨੂੰ ਨੋਟਸ ਜਾਂ ਡਾਇਰੀ ਵਿੱਚ ਲਿਖ ਲੈਂਦੀ ਹਾਂ ਧਿਆਨ ਕੇਂਦਰਿਤ ਕਰਨ ਲਈ ਇੱਕ ਸ਼ਾਂਤ ਥਾਂ ਮੈਨੂੰ ਫੋਨ ਜਾਂ ਹੋਰ ਡਾਇਰੈਕਸ਼ਨ ਤੋਂ ਦੂਰ ਜਾ ਕੇ ਲਿਖਣੀ ਸ਼ੁਰੂ ਕਰਦੀ ਹਾਂ ਕੋਈ ਵਿਲੇਖਣ ਜਾਂ ਖਾਕਾ ਬਣਾਉਣਾ ਜਿਵੇਂ ਲਿਖਣ ਤੋਂ ਪਹਿਲਾਂ ਵਿਸ਼ਾ ਮੁੱਖ ਬਿੰਦੂ ਜਾਂ ਢਾਂਚਾ ਤੈਅ ਕਰ ਲੈਂਦੀ ਹਾਂ